ਪਿਛਲੇ ਸਮੇਂ ਦੌਰਾਨ ਅਚਾਨਕ ਹੀ ਕਨੇਡਾ ਜਾਣ ਦਾ ਮੌਕਾ ਮਿਲਿਆ ਜਿੱਥੇ ਮੈਂ ਬਹੁਤ ਸਾਰੀਆਂ ਚੀਜ਼ਾਂ ਦੇਖ ਕੇ ਬਹੁਤ ਹੈਰਾਨ ਹੋਇਆ ਜਿਵੇਂ ਕਿ ਉੱਥੇ ਲੱਕੜ ਦੇ ਹੀ ਸਾਰੇ ਘਰ ਬਣੇ ਹੋਏ ਹਨ ਬੜੇ ਹੀ ਖੂਬਸੂਰਤ ਘਰ ਲੱਗਦੇ ਸਨ ਇਸ ਤੋਂ ਇਲਾਵਾ ਉੱਥੇ ਦੀਆਂ ਇੱਕ ਦੋ ਹੋਰ ਮਸ਼ਹੂਰ ਥਾਵਾਂ ਸਨ ਜਿਵੇਂ ਕਿ ਨਿਆਗਰਾ ਫਾਲ ਨਿਆਗਰਾ ਫਾਲ ਜਦੋਂ ਦੇਖਿਆ ਤਾਂ ਉੱਥੇ ਕੁਦਰਤੀ ਤੌਰ 'ਤੇ ਜਿਹੜਾ ਪਾਣੀ ਦੇ ਝਰਨੇ ਵਗਦੇ ਹੈ ਉਹਨਾਂ ਨੇ ਅ ਸਾਰੇ ਆਲ ਆਲੇ ਦੁਆਲੇ ਨੂੰ ਚਾਰ ਚੰਨ ਲਾਏ ਹੋਏ ਸਨ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਸਵਰਗ ਹੀ ਆ ਗਿਆ ਸਵਰਗ ਵਿੱਚ ਹੀ ਆ ਗਏ ਹੁੰਦੇ ਹਾਂ ਇਸੇ ਤਰ੍ਹਾਂ ਜਦੋਂ ਸੀ ਐੱਨ ਟਾਵਰ ਫੇਮਸ ਇਤਿਹਾਸਕ ਸਥਾਨ 'ਤੇ ਗਏ ਕਨੇਡਾ ਵਿਖੇ ਉੱਥੇ ਆਸਮਾਨ ਨੂੰ ਛੂੰਹਦੀਆਂ ਇਮਾਰਤਾਂ ਅਤੇ ਸੀ ਐੱਨ ਟਾਵਰ ਦੀ ਉਚਾਈ ਦੇਖ ਕੇ ਬਹੁਤ ਹੀ ਬਹੁਤ ਹੀ ਵੱਖਰਾ ਮਹਿਸੂਸ ਹੋਇਆ ਕਿ ਦੁਨੀਆ ਅੰਦਰ ਕਿਸ ਕਿਸ ਤਰ੍ਹਾਂ ਦੇ ਅਜੂਬੇ ਬਹੁਤ ਸਾਰੇ ਦਿਮਾਗ ਵਾਲੇ ਵਿਅਕਤੀਆਂ ਨੇ ਬਣਾਏ ਹਨ ਜਿਨ੍ਹਾਂ ਨੂੰ ਦੇਖ ਕੇ ਬਹੁਤ ਹੀ ਹੈਰਾਨੀ ਪ੍ਰਗਟ ਹੁੰਦੀ ਹੈ